ਮੈਂ ਥੋੜ੍ਹੇ ਦਿਨ ਪਹਿਲਾਂ ਫਲਿੱਪਕਾਰਟ ਤੋਂ ਫੋਨ ਓਡਰ ਕੀਤਾ ਸੀ ਮੈਂ ਆਪਣਾ ਫੋਨ ਬਦਲਣ ਲਈ ਸੋਚਿਆ ਕਿਉਂਕਿ ਮੇਰੇ ਫੋਨ ਦੀ ਸਟੋਰੇਜ ਫੁੱਲ ਹੋ ਗਈ ਅਤੇ ਮੈਂ ਸੋਚਿਆ ਕਿ ਮੈਂ ਇਸ ਵਾਰੀ ਜ਼ਿਆਦਾ ਸਟੋਰੇਜ ਵਾਲਾ ਫੋਨ ਲਵਾਂ ਜਿਹਦੇ 'ਚ ਮੈਨੂੰ ਆਹ ਵਾਲੀ ਦਿੱਕਤ ਨਾ ਆਵੇ ਅਤੇ ਜਿਹਨੂੰ ਮੈਂ ਜ਼ਿਆਦਾ ਸਮਾਂ ਯੂਜ਼ ਕਰ ਸਕਾਂ ਬਟ ਮੇਰਾ ਨਾ ਐਕਸਪੀਰੀਐਂਸ ਬਹੁਤ ਖਰਾਬ ਰਿਹਾ ਫਲਿੱਪਕਾਰਟ ਨਾਲ ਕਿਉਂਕਿ ਮੈਂ ਨਾ ਮਾਈਕਰੋ ਕੰਪਨੀ ਦਾ ਫੋਨ ਦੇਖ ਰਹੀ ਸੀਗੀ ਉਹਦੇ ਫੋਨ ਨੇ ਨਾ ਮੈਂ ਪਹਿਲਾਂ ਵੀ ਯੂਜ਼ ਕੀਤੇ ਹੈ ਵਧੀਆ ਹੁੰਦੇ ਹੈ ਅਤੇ ਉਨ੍ਹਾਂ ਦੀ ਸਟੋਰੇਜ ਵੀ ਵਧੀਆ ਚੱਲਦੀ ਹੈ ਕਾਫੀ ਟਾਈਮ ਤੱਕ ਰਿਹਾ ਜਾਂਦੇ ਆ ਫੋਨ ਤਿੰਨ ਚਾਰ ਸਾਲ ਆਰਾਮ ਨਾਲ ਕੱਢ ਸਕਦੇ ਹੈ ਕੋਈ ਵੀ ਇਨਸਾਨ ਜਿ ਜਿਹੜਾ ਮਤਲਬ ਔਫਿਸ ਦਾ ਵੀ ਕੰਮ ਕਰਦੇ ਹੈ ਅਤੇ ਮਤਲਬ ਘਰਦੇ ਵੀ ਕੁਝ ਸਟੱਫ ਰੱਖਦੇ ਹੈ ਆਪਣੇ ਫੋਨ ਦੇ ਵਿੱਚ ਬਟ ਮੈਂ ਜਦ ਫਲਿੱਪਕਾਰਟ 'ਤੇ ਫੋਨ ਦੇਖਿਆ ਨਾ ਮੈਨੂੰ ਕਾਫੀ ਮਹਿੰਗਾ ਵੀ ਲੱਗਿਆ ਅਤੇ ਜਦ ਮੈਂ ਫੋਨ ਦੇਖ ਰਹੀ ਸੀਗੀ ਤਾਂ ਮੈਂ ਦੇਖਿਆ ਕਿ ਚਲੋ ਕੋਈ ਨਾ ਮੈਂ ਥੋੜ੍ਹੇ ਜਿਹੇ ਪੈਸੇ ਹੋਰ ਲਾ ਲੈਂਦੀ ਹੈ ਵੀ ਮੈਨੂੰ ਅੱਗੇ ਲਈ ਸੌਖਾਲਾ ਹੋਜੂੰਗਾ ਥੋੜ੍ਹਾ ਜਿਹਾ ਕਿ ਮੈਂ ਜ਼ਿਆਦਾ ਟਾਈਮ ਯੂਜ਼ ਕਰ ਸਕਾਂਗੀ ਮੈਂ ਪੈਸੇ ਦੇ ਵਿੱਚ ਵੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਅਤੇ ਮੈਂ ਇਸ ਫਲਿੱਪਕਾਰਟ ਦੇ ਵਿੱਚ ਹੈ ਨਾ ਪੇਮੈਂਟ ਵੀ ਪਹਿਲਾਂ ਕਰਤੀ ਆਪਣੀ ਸਾਰੀ ਦੀ ਸਾਰੀ ਪੇਮੈਂਟ ਹੈ ਨਾ ਓਡਰ ਤੋਂ ਹੀ ਪਹਿਲਾਂ ਕਰਤੀ ਅਤੇ ਜਦ ਮੇਰੇ ਕੋਲ਼ ਫੋਨ ਆਇਆ ਮੈਂ ਦੇਖਿਆ ਉਹ ਫੋਨ ਤਾਂ ਮੋਡਲ ਵੀ ਕੋਈ ਹੋਰ ਸੀਗਾ ਉਹਦੇ ਵਿੱਚ ਓਨੀ ਸਟੋਰੇਜ ਵੀ ਨਹੀਂ ਸੀਗੀ ਪਲੱਸ ਉਹਦਾ ਟੱਚ ਵੀ ਖਰਾਬ ਸੀਗਾ ਇੱਦਾਂ ਲੱਗ ਰਿਹਾ ਸੀਗਾ ਕਿਸੇ ਨੇ ਮੈਨੂੰ ਯੂਜ਼ ਫੋਨ ਹੀ ਦੇਤਾ ਉਹਦਾ ਕੀਪੈਡ ਵਗੈਰਾ ਸਭ ਕੁਝ ਖਰਾਬ ਸੀਗਾ ਸਭ ਕੁਛ ਉਹਦੀ ਸਿੱਮ ਈਜੈਕਟਰ ਪਿੰਨ ਵੀ ਹੈ ਮਤਲਬ ਮੁੜੀ ਹੋਈ ਸੀਗੀ ਉਹ ਵੀ ਚੱਜ ਨਾਲ ਕੰਮ ਨਹੀਂ ਕਰ ਰਹੀ ਸੀਗੀ ਅਤੇ ਮੈਂ ਅੱਜ ਤੋਂ ਬਾਅਦ ਫਲਿੱਪਕਾਰਟ ਦੇ ਫਲਿੱਪਕਾਰਟ ਤੋਂ ਕੁਝ ਵੀ ਨਹੀਂ ਓਡਰ ਕਰੂੰਗੀ